ਛੇ ਮਹੀਨਿਆਂ ਬਾਦ ਫਸਲ ਪੱਕਣ ਤੇ ਉਸਨੂੰ ਵੱਢ ਕੇ ਕਿਸਾਨ ਮੰਡੀ ਦੇ ਵਿੱਚ ਲਿਜਾ ਕੇ ਵੇਚਦਾ ਹੈ ਇਸ ਮੰਡੀ ਨੂੰ ਮਾਰਕਿਟ ਕਿਹਾ ਜਾਂਦਾ ਹੈ ਇਸ ਮਾਰਕੀਟ ਦੇ ਵਿੱਚ ਜਦੋਂ ਉਹ ਆਪਣੀ ਫਸਲ ਨੂੰ ਲਿਜਾ ਕੇ ਵੇਚਦਾ ਹੈ ਤਾਂ ਉਸਨੂੰ ਆਪਣੀ ਫਸਲ ਦਾ ਭਾਅ ਮਿਲ ਜਾਂਦਾ ਹੈ ਕਈ ਵਾਰ ਇਹ ਭਾਅ ਉਸਨੂੰ ਚੰਗਾ ਪ੍ਰਾਪਤ ਹੋ ਜਾਂਦਾ ਹੈ ਕਈ ਵਾਰ ਮਾੜਾ ਪ੍ਰਾਪਤ ਹੁੰਦਾ ਐ ਜੇ ਗੱਲ ਅਸੀਂ ਹੋਰ ਸੂਬਿਆਂ ਦੀ ਕਰੀਏ ਤਾਂ ਅਸੀਂ ਦੇਖਦੇ ਹਾਂ ਕੀ ਹੋਰ ਸੂਬਿਆਂ ਦੇ ਵਿੱਚ ਇੱਕ ਵਿਚੋਲਾ ਵਪਾਰੀ ਕੀਤੀ ਜਾਂਦੀ ਹੈ ਵਿਚੋਲਾ ਵਪਾ ਵਪਾਰੀ ਤੋਂ ਭਾਵ ਕੀ ਸਰਕਾਰ ਸਿੱਧੇ ਪੈਸੇ ਨਹੀਂ ਲੈਂਦੀ ਜਾਂ ਸਿੱਧੀ ਕਣਕ ਕਿਸਾਨਾਂ ਤੋਂ ਨਹੀਂ ਲੈ ਸਕਦੀ ਇਸ ਲਈ ਵਿੱਚ ਆੜ੍ਹਤੀਏ ਦਾ ਕੰਮ ਵਿਚੋਲੇ ਵਾਲਾ ਹੁੰਦਾ ਹੈ ਆੜ੍ਹਤੀਆ ਕਿਸਾਨਾਂ ਤੋਂ ਫਸਲ ਲੈਂਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਭਾਅ ਦਿੰਦਾ ਹੈ ਇਹ ਸਰਕਾਰ ਸਿੱਧੀ ਲੈਣ ਦੇਣ ਨਹੀਂ ਕਰਦੀ ਕਿਸਾਨਾਂ ਦੇ ਨਾਲ ਇਸ ਲਈ ਆੜ੍ਹਤੀਏ ਨੂੰ ਵਿੱਚ ਵਿਚੋਲੇ ਦੀ ਤਰਾਂ ਇਹ ਕੰਮ ਕਰਦੇ ਹਨ